ਜੇਕਰ ਮੈਂ ਕਿਸੇ ਨਵਾਂ ਸਮਾਰਟਫੋਨ ਖਰੀਦਣਾ ਹੋਵੇ ਤਾਂ ਮੈਂ ਕੁਛ ਮੁੱਖ ਗੱਲਾਂ ਦਾ ਧਿਆਨ ਰੱਖਦੀ ਹਾਂ ਜੋ ਸਮਾਰਟਫੋਨ ਦੀ ਕਾਰਗੁਜ਼ਾਰੀ ਕੀਮਤ ਅਤੇ ਲੰਬੇ ਸਮੇਂ ਦੀ ਵਰਤੋਂ ਲਈ ਮਹੱਤਵਪੂਰਨ ਹੁੰਦੀਆਂ ਹਨ ਇਸ ਦੇ ਨਾਲ ਨਾਲ ਮੈਂ ਆਨਲਾਈਨ ਆਫਲਾਈਨ ਮਾਰਕੀਟ ਦੀ ਤੁਲਨਾ ਕਰਦੀ ਹਾਂ ਆਓ ਇੱਕ ਇੱਕ ਬਾਰੇ ਸਮਝੀਏ ਸਮਾਰਟਫੋਨ ਖਰੀਦਣ ਦੇ ਸਮੇਂ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਸਭ ਤੋਂ ਪਹਿਲਾਂ ਮੈਂ ਆਪਣੇ ਬਜਟ ਨੂੰ ਧਿਆਨ ਰੱਖਦੀ ਹਾਂ ਸਮਾਰਟਫੋਨ ਦੇ ਵੱਖ ਵੱਖ ਹੇਠਲੇ ਅਤੇ ਉੱਚੇ ਵੈਰੀਇਚ ਹੁੰਦੇ ਹਨ ਇਸ ਵਿੱਚ ਇਸ ਲਈ ਮੇਰੇ ਬਜਟ ਦੇ ਅੰਦਰ ਹੀ ਕਿਹੜਾ ਮਾਡਲ ਮੇਰੇ ਲਈ ਵਧੀਆ ਉਹਨੂੰ ਠਹਿਰਾਉਂਦੀ ਹਾਂ ਪ੍ਰੋਸੈਸ ਕਿਉਂਕਿ ਇਹ ਸਮਾਰਟਫੋਨ ਦੀ ਗਤੀ ਅਤੇ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੇ ਹਨ ਮੈਂ ਇਸ ਗੱਲ ਦਾ ਧਿਆਨ ਰੱਖਦੀ ਹਾਂ ਕਿ ਫੋਨ ਦੇ ਪ੍ਰੋਸੈਸ ਅਤੇ ਆਰ ਏ ਐਮ ਮੇਰੇ ਡੇਲੀ ਟਾਸਕ ਅਤੇ ਗੇਮਿੰਗ ਵਿਚ ਪ੍ਰਦਰਸ਼ਨ ਨਾਲ ਕਈ ਕੰਮਾਂ ਨੂੰ ਕਾਫ਼ੀ ਹੋਣ ਮੈਂ ਆਪਣੇ ਫੋਨ ਦੇ ਡਿਸਪਲੇ ਲਈ ਕਾਫ਼ੀ ਧਿਆਨ ਦਿੰਦੀ ਹਾਂ ਇਹ ਬਹੁਤ ਵਧੀਆ ਅਤੇ ਰੀਅਲ ਸਿਨੇਮਾਟੱਕ ਅਨੁਭਵ ਦੇਣ ਲਈ ਮੈਨੂੰ ਐਚ ਡੀ ਜਾਂ ਚਾਰ ਕੇ ਰੈਜੋਲੂਸਨ ਅਤੇ ਓ ਐਲ ਈ ਡੀ ਜਾਂ ਐਮੋਲਿਡ ਪੈਨਲ ਚਾਹੀਦਾ ਹੈ ਜੋ ਰੰਗਾਂ ਨੂੰ ਜੀਵਤ ਬਣਾਉਂਦੇ ਹਨ ਕੈਮਰਾ ਫੀਚਰ ਦੇ ਨਾਲ ਕਿਉਂਕਿ ਮੈਂ ਫੋਨ ਨੂੰ ਕਈ ਵਾਰ ਫੋਟਸ ਅਤੇ ਵੀਡੀਓ ਖਿੱਚਣ ਲਈ ਵਰਤਦੀ ਹਾਂ ਮੈਂ ਬੈਟਰੀ ਦੀ ਸਮਰੱਥਾ ਅਤੇ ਫਾਸਟ ਚਾਰਜਿੰਗ ਸਮਰੱਥਾ ਨੂੰ ਵੀ ਵੇਖਦੀ ਹਾਂ ਫੋਨ ਦੀ ਸਟੋਰੇਜ ਵੀ ਇੱਕ ਮੁੱਖ ਫੈਕਟਰ ਹੁੰਦੀ ਹੈ ਜੇਕਰ ਮੈਂ ਵੱਡੀ ਸਟੋਰੇਜ ਜੇਕਰ ਮੈਂ ਵੱਡੀ ਸਟੋਰੇਜ ਵਾਲਾ ਫੋਨ ਚਾਹੁੰਦੀ ਹਾਂ ਤਾਂ ਮੈਂ ਇੱਕ ਸੌ ਅਠਾਈ ਜੀ ਬੀ ਜਾਂ ਦੋ ਪੰਜ ਛੇ ਜੀ ਬੀ ਵਾਲੇ ਮਾਡਲ ਦੀ ਖੋਜ ਕਰਦੀ ਹਾਂ